ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਹਾਂ ਸਭ ਤੋਂ ਪਹਿਲਾਂ ਮੈਮ ਵੈਲਕਮ ਪਟਿਆਲਾ ਹਾਂਜੀ ਮੈਮ ਪਟਿਆਲਾ ਦੇ ਵਿੱਚ ਹਰ ਜਗ੍ਹਾ 'ਤੇ ਪਾਰਕ ਹੈ ਅਰਬਨ ਸਟੇਟ ਫੇਸ ਵਨ ਦੇ ਵਿੱਚ ਅਰਬਨ ਸਟੇਟ ਫੇਸ ਥਰੀ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਪਾਰਕ ਹੈ ਹੈ ਨਾ ਤੁਸੀਂ ਹਰ ਕਲੋਨੀ ਦੇ ਵਿੱਚ ਪਾਰਕ ਆ ਜਿੱਥੇ ਵੀ ਤੁਸੀਂ ਮੋਤੀ ਬਾਗ ਦੇ ਵਿੱਚ ਪਾਰਕ ਹੈ ਮੈਮ ਹਾਂਜੀ ਹਾਂਜੀ ਇੱਥੇ ਤੁਸੀਂ ਵਿਜਿਟ ਕਰ ਸਕਦੇ ਓਂ ਹਾਂਜੀ ਮੈਮ ਪਾਰਕਾਂ ਦੇ ਵਿੱਚ ਗਰਡਨ ਹੈ ਮੈਮ ਇੱਥੇ ਬਾਰਾਬਰੀ ਗਾਰਡਨ ਹੈ ਉਹਦੇ ਵਿੱਚ ਜਿਹੜਾ ਮੇਲਾ ਲੱਗਦਾ ਅਤੇ ਇੱਕ ਰੋਜ਼ ਗਾਰਡਨ ਹੈ ਜਿਹੜਾ ਉੱਥੇ ਮਤਲਬ ਕਾਫੀ ਮੇਲੇ ਵਗੈਰਾ ਲੱਗਦੇ ਨੇ ਯੂਨੀਵਰਸਿਟੀ ਦੇ ਵਿੱਚ ਮੈਮ ਜਿੱਦਾਂ ਫੁੱਲਾਂ ਦਾ ਮੇਲਾ ਲੱਗਦਾ ਹੈ ਨਾ ਤਰ੍ਹਾਂ ਤਰ੍ਹਾਂ ਦੇ ਉੱਥੇ ਫਲਾਵਰ ਹੁੰਦੇ ਨੇ ਹਾਂਜੀ ਅਤੇ ਮੇਲੇ ਦੇ ਵਿੱਚ ਮੈਮ ਜਿੱਦਾਂ ਜਿ ਜਿਹੜਾ ਇੱਕ ਬੱਸ ਸਟੈਂਡ ਦੇ ਕੋਲ ਗਾਰਡਨ ਦੇ ਵਿੱਚ ਜਿਹੜਾ ਮੇਲਾ ਲੱਗਦਾ ਉੱਥੇ ਕਾਫੀ ਤਰ੍ਹਾਂ ਦੇ ਮਤਲਬ ਕਿ ਝੂਲੇ ਹੁੰਦੇ ਨੇ ਹੈ ਨਾ ਉਹ ਵੀ ਤੁਸੀਂ ਵਿਜਿਟ ਕਰ ਸਕਦੇ ਓਂ ਹਾਂਜੀ ਮੈਮ ਯੂਨੀਵਰਸਿਟੀ ਦੇ ਵਿੱਚ ਮੈਮ ਯੂਨੀਵਰਸਿਟੀ ਦੇ ਵਿੱਚ ਜਿਹੜਾ ਫੁੱਲਾਂ ਦਾ ਮੇਲਾ ਚੱਲ ਰਿਹਾ ਹੈ ਨਾ ਉਹ ਤੁਸੀਂ ਦੇਖ ਸਕਦੇ ਓਂ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਜਿਹੜੇ ਫੁੱਲ ਫਲਾਰਸ ਮਿਲਣਗੇ ਵੱਖਰੀਆਂ ਵੱਖਰੀਆਂ ਉਹਨਾਂ ਦੀਆਂ ਕਿਸਮਾਂ ਹੋਣਗੀਆਂ ਹੈ ਨਾ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਉਹ ਵ ਇੱਕ ਵੀਕ ਦੇ ਕਰੀਬ ਜਿਹੜਾ ਰਹੇਗਾ ਇੱਕ ਹਫਤਾ ਹਾਂਜੀ ਹਾਂਜੀ ਹੋਰ ਮੈਮ ਸ਼ੀਸ਼ ਮਹਿਲ ਹੈਗਾ ਹੈ ਨਾ ਇੱਥੇ ਤੁਸੀਂ ਵਿਜਿਟ ਕਰ ਸਕਦੇ ਓਂ ਸਰਸ ਮੇਲਾ ਲੱਗੇਗਾ ਸ਼ੀਸ਼ ਮਹਿਲ ਦੇ ਵਿੱਚ ਉਹਨੂੰ ਵਿਜਿਟ ਕਰ ਸਕਦੇ ਹੋ ਜਿੱਥੇ ਪੁਰਾਣੀਆਂ ਮਤਲਬ ਪੁਰਾਣੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਤੁਹਾਨੂੰ ਹਾਂਜੀ ਠੀਕ ਹੈ ਜੀ ਓਕੇ ਮੈਮ ਓਕੇ ਜੀ ਵੈਲਕਮ ਮੈਮ ਵੈਲਕਮ ਓਕੇ ਜੀ